ਹੈਲੋ ਨਮਸਕਾਰ ਜੀ ਨਰੇਸ਼ ਕੁਮਾਰ ਬੋਲ ਰਿਹਾ ਪੰਜਾਬ ਦੇ ਵਿੱਚ ਮਨੋਰੰਜਨ ਦਾ ਬਹੁਤ ਹੀ ਵਧੀਆ ਉਪਰਾਲਾ ਹੋ ਰਿਹਾ ਆ ਮਨੋਰੰਜਨ ਦੇ ਵਿੱਚ ਸਾਡੇ ਇੱਥੇ ਸਿੰਗਰ ਮਤਲਬ ਕਿ ਬਹੁਤ ਅੱਗੇ ਜਾ ਰਹੇ ਨੇ ਹਾਲੀਵੁੱਡ ਦੇ ਵਿੱਚ ਵੀ ਅੱਜ ਕੱਲ੍ਹ ਪੰਜਾਬ ਦੇ ਸਿੰਗਰਾਂ ਦਾ ਜ਼ਿਆਦਾ ਯੋਗਦਾਨ ਹੋ ਰਿਹਾ ਆ ਯੋਗਦਾਨ ਹੋ ਰਿਹਾ ਆ ਇੱਥੇ ਲੋਕ ਮੱਕੀ ਵੱਧ ਤੋਂ ਵੱਧ ਇੱਕ ਦਿਨ ਦੀ ਕਮਾਈ ਵੱਧ ਰਹੀ ਹੈ ਜ਼ਿਆਦਾ ਮਤਲਬ ਕਿ ਅੱਜ ਕੱਲ੍ਹ ਚਲੋ ਸ਼ੋਸ਼ਲ ਮੀਡੀਆ 'ਤੇ ਆ ਗਿਆ ਸੋਸ਼ਲ ਮੀਡੀਆ 'ਤੇ ਲੋਕ ਗਾਣੇ ਬਹੁਤ ਸੁਣਦੇ ਜਾਂ ਪਾ ਰਹੇ ਆ ਮਤਲਬ ਕਿ ਸਿੰਗਿੰਗ ਦਾ ਜ਼ਿਆਦਾ ਮਤਲਬ ਕਿ ਲੋਕਾਂ ਨੂੰ ਸ਼ੌਕ ਹੈ ਜ਼ਿਆਦਾ ਵਧ ਰਿਹਾ ਆ ਸਿੰਗਿੰਗ ਦਾ ਮਨੋਰੰਜਨ ਹੋ ਰਿਹਾ ਲੋਕਾਂ ਦਾ ਇਸ ਨਾਲ ਫੋਨ ਦੇ ਨਾਲ ਫੋਨ ਹਰ ਬੱਚਾ ਫੋਨ ਦੇ ਨਾਲ ਜੁੜਿਆ ਹੋਇਆ ਮਨੋਰੰਜਨ ਹੈ ਇੱਕ ਤਾਂ ਦਿਮਾਗ ਫਰੈਸ਼ ਹੋ ਰਿਹਾ ਲੋਕਾਂ ਦਾ ਦਿਮਾਗ ਫਰੈਸ਼ ਰਹਿੰਦਾ ਹੈ ਬਿਜ਼ਨਸ ਦੇ ਵਿੱਚ ਵੀ ਬੰਦੇ ਦਾ ਯੋਗਦਾਨ ਹੋ ਰਿਹਾ ਆ ਗਾਇਕਾਂ ਦੀ ਵੈਲਿਊ ਵਧ ਰਹੀ ਹੈ ਇਨਕਮ ਵੱਧ ਰਹੀ ਹੈ ਨਵੀਆਂ ਨਵੀਆਂ ਫਿਲਮਾਂ ਆ ਰਹੀਆਂ ਆ ਜਿੱਦਾਂ ਜਿੱਦਾ ਮਤਲਬ ਕਿ ਅੱਜ ਕੱਲ੍ਹ ਚੱਲਦੇ ਆ ਹਰ ਬੰਦੇ ਨੂੰ ਰੁਜ਼ਗਾਰ ਮਿਲ ਮਿਲ ਰਿਹਾ ਇਹਦੇ ਕਰਕੇ ਫਿਲਮਾਂ ਕਰਕੇ ਮੂਵੀਜ਼ ਕਰਕੇ ਮਨੋਰੰਜਨ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ